ਮੈਂ ਵੈਸੇ ਤਾਂ ਕਦੀ ਵਰਚੁਅਲ ਰਿਐਲਿਟੀ ਹੈਂਡਸੈਟ ਦੀ ਵਰਤੋਂ ਨਹੀਂ ਕੀਤੀ ਹੈ ਪਰ ਮੈਂ ਇਸ ਬਾਰੇ ਇੰਨਾਂ ਦੱਸ ਸਕਦੀ ਹਾਂ ਕਿ ਇਸ ਰਾਹੀਂ ਆਪਾਂ ਇੱਕ ਇੱਦਾਂ ਦੇ ਜੀਵਨ 'ਚ ਪ੍ਰਵੇਸ਼ ਕਰ ਜਾਂਦੇ ਹਾਂ ਜਿਹਦਾ ਅਸਲ 'ਚ ਕੋਈ ਮੁੱਲ ਨਹੀਂ ਹੁੰਦਾ ਅਸਲ 'ਚ ਉਹ ਮੌਜੂਦ ਹੀ ਨਹੀਂ ਹੁੰਦਾ ਹੈ ਇਸ ਵਿੱਚ ਆਪਣੇ ਅੱਖਾਂ ਉੱਤੇ ਵਰਚੁਅਲ ਰਿਐਲਿਟੀ ਹੈਡਸੈਟ ਲਾਇਆ ਜਾਂਦਾ ਹੈ ਜਿਸ ਰਾਹੀਂ ਸਾਨੂੰ ਉਹ ਸਾਰੀਆਂ ਚੀਜ਼ਾਂ ਦਿਖਦੀਆਂ ਨੇ ਇਸ ਵਿੱਚ ਅਸੀਂ ਇੱਕ ਪਲੇਅਰ ਹੁੰਦੇ ਹਨ ਸਾਰੇ ਚੀਜ਼ਾਂ ਆਪਣੀ ਇਮੈਜਿਨਰੀ ਹੁੰਦੀਆਂ ਹਨ ਕੁਝ ਵੀ ਚੀਜ਼ ਰੀਅਲ 'ਚ ਮੌਜੂਦ ਨਹੀਂ ਹੁੰਦੀ ਪਰ ਫਿਰ ਵੀ ਸਾਡੇ ਕੋਲ ਇੱਕ ਜਿਵੇਂ ਕਿ ਵੀਡੀਓ ਗੇਮਿੰਗ ਤਰ੍ਹਾਂ ਦਾ ਹੁੰਦਾ ਹੈ ਸਾਨੂੰ ਇੱਦਾਂ ਲੱਗਦਾ ਕਿ ਅਸੀਂ ਉਸ ਗੇਮ ਦੇ ਅੰਦਰ ਹੀ ਹਾਂ ਅਤੇ ਉਸ ਨੂੰ ਇੱਕ ਬੰਦਾ ਹੈ ਜਿਹੜਾ ਕਿ ਉਹ ਤੁਸੀਂ ਆਪ ਔ ਜਿਹੜਾ ਕਿ ਉਸ ਗੇਮ ਨੂੰ ਖੇਡ ਰਿਹਾ ਹੈ ਜਿਹੜਾ ਕੁਝ ਹੋਊਗਾ ਉਹ ਤੁਹਾਡੇ ਨਾਲ ਹੋਊਗਾ ਸਭ ਕੁਝ ਸਾਨੂੰ ਇੱਦਾਂ ਲੱਗਦਾ ਕਿ ਜਿਵੇਂ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਆਪਾਂ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਉੱਦਾਂ ਹੀ ਆਪਾਂ ਉਸ ਗੇਮ ਵਿੱਚ ਵੀ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਮੇਰੇ ਅਕੋਰਡਿੰਗ ਇਹ ਬਹੁਤ ਹੀ ਵਧੀਆ ਅਤੇ ਵਧੀਆ ਅਤੇ ਅੱਛਾ ਐਕਸਪੀਰੀਅੰਸ ਹੁੰਦਾ ਹੈ ਅਗਰ ਕੋਈ ਇਸ ਗੇਮ ਨੂੰ ਖੇਡਦਾ ਹੈ ਕਿਉਂਕਿ ਉਹ ਇੱਕ ਅਲੱਗ ਹੀ ਦੁਨੀਆਂ ਵਿੱਚ ਪ੍ਰਵੇਸ਼ ਕਰ ਜਾਂਦਾ ਹੈ ਜਿਸ ਨਾਲ ਹੀ ਉਸ ਨੂੰ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਗੇਮ ਜਦੋਂ ਆਪਾਂ ਕੋਈ ਖੇਡਦੇ ਹਾਂ ਤਾਂ ਉਸ ਵਿੱਚ ਜਦੋਂ ਆਪਾਂ ਆਪਣੇ ਆਪ ਨੂੰ ਰਿ ਰਿਐਲਿਟੀ 'ਚ ਮਹਿਸੂਸ ਕਰਦੇ ਹਾਂ ਤਾਂ ਉਸ ਦਾ ਮਜ਼ਾ ਅਲ ਵੱਖਰਾ ਹੀ ਹੁੰਦਾ ਹੈ